ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਆ ਨੈਕਸਟ ਵੀਕ ਆਉਣਾ ਚਾਹੁੰਦੇ ਆ ਰਿਹਾ ਹਫ਼ਤਾ ਉਸ ਦੇ ਵਿੱਚ ਹਾਂਜੀ ਹਾਂ ਅਤੇ ਇਹਦੇ ਵਿੱਚ ਇਸ ਤਰ੍ਹਾਂ ਏ ਜੀ ਕਿ ਆਪਣਾ ਅਠਾਈ ਦਾ ਨਗਰ ਕੀਰਤਨ ਹੁੰਦਾ ਅਤੇ ਨਗਰ ਕੀਰਤਨ ਤੋਂ ਪਹਿਲੇ ਜਿਹੜੇ ਦੋ ਦਿਨ ਨੇ ਉਹਦੇ ਥੋੜ੍ਹਾ ਜਿਹਾ ਰਸ਼ ਘੱਟ ਹੁੰਦਾ ਅਤੇ ਐਂਟਰੀ ਵੀ ਥੋੜ੍ਹੀ ਜਿਹੀ ਨੇੜੇ ਤੱਕ ਆ ਜਾਂਦੀ ਆ ਆਪਣੇ ਗੁਰਦੁਆਰਾ ਸਾਹਿਬ ਦੇ ਅਤੇ ਉਸ ਦਿਨ ਨਗਰ ਕੀਰਤਨ ਵਾਲੇ ਦਿਨ ਤਾਂ ਸੜਕਾਂ ਜਾਮ ਹੋ ਜਾਂਦੀਆਂ ਨੇ ਅਤੇ ਦੁਪਹਿਰ ਤੋਂ ਬਾਅਦ ਵੀ ਜਿਹੜੇ ਲੰਗਰ ਨੇ ਉਹ ਉਹਨਾਂ ਦੀਆਂ ਟਰਾਲੀਆਂ ਵਗੈਰਾ ਆਪਣੇ ਨਿੱਜੀ ਪਿੰਡਾਂ ਵੱਲ ਨੂੰ ਤੁਰ ਪੈਂਦੇ ਨੇ ਉਹ ਜਿਸ ਕਰਕੇ ਜਾਮ ਕਾਫ਼ੀ ਹੋ ਜਾਂਦਾ ਤਾਂ ਵਧੀਆ ਤਾਂ ਇਹੀ ਰਹੇਗਾ ਕਿ ਤੁਸੀਂ ਪਹਿਲੇ ਦੋ ਦਿਨ ਦੇ ਵਿੱਚ ਆਪਣਾ ਇੱਥੇ ਆ ਕੇ ਨਮਸ਼ਕਾਰ ਕਰ ਲਉ ਹਾਂ ਉਹ ਇਸ ਤਰ੍ਹਾਂ ਤੁਸੀਂ ਦਿੱਲੀ ਤੋਂ ਆਊਂਗੇ ਨਾ ਉੱਥੇ ਜੀਟੀ ਰੋਡ ਦੇ ਉੱਪਰ ਉੱਥੇ ਸਰਹੰਦ ਬੱਸ ਸਟੈਂਡ ਆ ਉਹਦੇ ਅੰਦਰ ਨੂੰ ਆ ਕੇ ਤੁਸੀਂ ਆ ਜਾਓਗੇ ਫਲਾਈਓਵਰ ਤੋਂ ਹਾਂਜੀ ਸਰਹੰਦ ਮੰਡੀ ਦੇ ਵਿੱਚ ਹੁੰਦੇ ਹੋਏ ਅਤੇ ਇੱਕ ਉੱਥੇ ਆਉਂਦਾ ਆਮ ਖ਼ਾਸ ਬਾਗ਼ ਉੱਥੋਂ ਰਸਤਾ ਕੱਟਦਾ ਪੁਰਾਣੀ ਸਰਹੰਦ ਨੂੰ ਉੱਧਰ ਨੂੰ ਵੀ ਜਾ ਸਕਦੇ ਹੋ ਬਾਕੀ ਉੱਥੇ ਨਾ ਬੈਰੀਗੇਡ ਲ ਲੱਗੇ ਹੁੰਦੇ ਨੇ ਪੁਲਿਸ ਦੇ ਉਹ ਦੱਸ ਦਿੰਦੇ ਆ ਵੀ ਕਿੱਥੇ ਪਾਰਕਿੰਗ ਨੀਅਰਸਟ ਪਾਰਕਿੰਗ ਹੈਗੀ ਆ ਉੱਥੇ ਤੁਸੀਂ ਆਪਣੀ ਗੱਡੀ ਪਾਰਕ ਕਰ ਸਕਦੇ ਓਂ ਅਤੇ ਕਈ ਸਕੂਲਾਂ ਨੇ ਨਾ ਫ੍ਰੀ ਬੱਸ ਸੇਵਾ ਵੀ ਸ਼ੁਰੂ ਕੀਤੀ ਹੁੰਦੀ ਆ ਸਕੂਲਾਂ ਕਾਲਜਾਂ ਨੇ ਜਾਂ ਕੋਈ ਹੋਰ ਸੋਸਾਇਟੀ ਹੁੰਦੀ ਆ ਅਤੇ ਉਹ ਪਾਰਕਿੰਗ ਏਰੀਆ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੱਕ ਪਹੁੰਚ ਜਾਂਦੇ ਆ ਤੁਰਨਾ ਪੈਂਦਾ ਥੋੜ੍ਹਾ ਜਿਹਾ ਹਾਂਜੀ

ਹਾਂ ਇਸ ਤਰ੍ਹਾਂ ਜੀ ਜਿਹੜਾ ਮੇਨ ਗੁਰਦੁਆਰਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਉਹ ਅਤੇ ਜਿੱਥੇ ਸ਼ਹੀਦੀ ਹੋਈ ਸੀ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਗੁਰਦੁਆਰਾ ਜੋਤੀ ਸਰੂਪ ਜਿੱਥੇ ਸਸਕਾਰ ਕੀਤਾ ਸੀਗਾ ਅਤੇ ਉਹ ਜਾਣੀ ਕਿ ਇੱਕ ਸੜਕ ਹੈਗੀ ਆ ਡਾਇਰੈਕਟ ਵੱਡੇ ਗੁਰਦੁਆਰੇ ਤੋਂ ਜੋਤੀ ਸਰੂਪ ਸਾਹਿਬ ਵੱਲ ਅਤੇ ਉਹ ਯੂਨੀਵਰਸਿਟੀ ਦੇ ਅੱਗਿਓਂ ਹੋ ਕੇ ਜਾਂਦੀ ਆ ਯੂਨੀਵਰਸਿਟੀ ਦੇ ਅੱਗਿਓ ਅਤੇ ਇੱਕ ਮੋਤੀ ਰਾਮ ਮਹਿਰਾ ਜੀ ਦਾ ਗੁਰਦੁਆਰਾ ਉਹ ਵੱਡੇ ਗੁਰਦੁਆਰੇ ਤੋਂ ਉਲਟੇ ਪਾਸੇ ਨੂੰ ਜਾਣੀ ਕਿ ਇੱਕ ਫਾਟਕ ਆਉਂਦਾ ਉਸ ਤੋਂ ਅੱਗੇ ਆ ਹਾਂਜੀ ਉੱਥੇ ਜਿਵੇਂ ਨਾ ਆਪਣੇ ਪੁਲਿਸ ਵਾਲੇ ਵੀ ਹੁੰਦੇ ਆ ਅਤੇ ਜਿਹੜੇ ਸੇਵਾਦਾਰ ਉਹ ਵੀ ਦੱਸ ਦਿੰਦੇ ਆ ਵੀ ਕਿੱਧਰ ਨੂੰ ਰਸਤਾ ਹੈਗਾ ਬਾਕੀ ਤੁਹਾਨੂੰ ਉੱਥੇ ਆ ਕੇ ਪਤਾ ਲੱਗ ਹੀ ਜਾਏਗਾ ਜੀ ਹਾਂਜੀ ਹਾਂਜੀ ਹਾਂਜੀ ਹਾਂ ਜ਼ਰੂਰ ਜੀ ਕੋਈ ਚੱਕਰ ਨਹੀਂ ਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ